ਮੇਰਾ ਮਨਪਸੰਦ ਅਖਬਾਰ ਦਾ ਹਿੰਦੂ ਹੈ ਕਿਉਂਕਿ ਇਹ ਮੇਰੇ ਇਲਾਕੇ ਵਿੱਚ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ ਅਤੇ ਇਸਦਾ ਪ੍ਰਾਈਸ ਵੀ ਠੀਕ ਹੈ ਅਤੇ ਇਸ ਤੋਂ ਇਲਾਵਾ ਇਸ ਵਿੱਚ ਦੇਸ਼ ਦੁਨੀਆਂ ਦੀ ਨਿਊਜ਼ ਵਧੀਆ ਤਰੀਕੇ ਨਾਲ ਦਿੱਤੀ ਜਾਂਦੀ ਹੈ ਅਤੇ ਇਸ ਦੇ ਲਿਖਣ ਦਾ ਤਰੀਕਾ ਵੀ ਵਧੀਆ ਹੈ ਜੋ ਬਜ਼ੁਰਗ ਅਤੇ ਬ ਨੌਜਵਾਨ ਬੱਚੇ ਵੀ ਆਸਾਨੀ ਨਾਲ ਪੜ੍ਹ ਸਕਦੇ ਹਨ ਇਸ ਤੋਂ ਇਲਾਵਾ ਏ ਇਸ ਵਿੱਚ ਕਈ ਤਰ੍ਹਾਂ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਜਿਵੇਂ ਸਾਇੰਸ ਟੈਕਨੋਲੋਜੀ ਵਾਤਾਵਰਨ ਖੇਡਾਂ ਔਰ ਦੇਸ਼ ਵਿੱਚ ਹੋਰ ਕੀ ਹੋ ਰਿਹਾ ਉਸ ਬਾਰੇ ਵੀ ਵਧੀਆ ਤਰੀਕੇ ਨਾਲ ਦੱਸਿਆ ਜਾਂਦਾ ਅਤੇ ਇਸ ਲਈ ਮੈਨੂੰ ਇਹ ਵਧੀਆ ਲੱਗਦਾ ਹੈ ਅਤੇ ਇਸ ਵਿੱਚ ਹਰ ਵਿਸ਼ੇ ਉੱਤੇ ਵਿਚਾਰ ਪ੍ਰਗਟ ਕੀਤੇ ਹੁੰਦੇ ਹਨ ਅਤੇ ਉਹ ਵਿਚਾਰ ਹਰ ਪਾਸੇ ਦਾ ਭਾਵ ਤੋਲ ਕੇ ਦੱਸੇ ਜਾਂਦੇ ਹਨ ਕਿ ਉਹ ਨਾ ਹੀ ਕਿਸੇ ਨੂੰ ਜ਼ਿਆਦਾ ਕੁਛ ਮਾੜਾ ਕਹਿੰਦੇ ਹਨ ਨਾ ਹੀ ਕਿਸੇ ਨੂੰ ਕੁਛ ਜ਼ਿਆਦਾ ਚੰਗਾ ਕਹਿੰਦੇ ਨੇ ਉਹ ਸਭ ਸੋਚ ਸਮਝ ਕੇ ਇਹ 'ਚ ਲਿਖਿਆ ਜਾਂਦਾ ਹੈ ਇਸ ਲਈ ਇਹ ਮੈਨੂੰ ਸਭ ਤੋਂ ਵਧੀਆ ਲੱਗਦਾ ਹੈ